ਹਾਂ ਮੈਂ ਸਕਰੈਚ ਤੋਂ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਘਰ ਵਿੱਚ ਮੈਂ ਕਲਾ ਅਤੇ ਸ਼ਿਲਪਕਾਰੀ ਨਾਲ ਬਹੁਤ ਕੁਝ ਸਜਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ ਮੈਂ ਆਪਣੇ ਘਰ ਵਿੱਚ ਬਹੁਤ ਸਾਰੀਆਂ ਤਸਵੀਰਾਂ ਬਣਾ ਬਣਾ ਕੇ ਲਗਾਈਆਂ ਹਨ ਜਿਵੇਂ ਕਿਸੇ ਜਿਵੇਂ ਕਿ ਇੱਕ ਵਾਰੀ ਮੈਂ ਸ਼ਿਵ ਜੀ ਦੀ ਤਸਵੀਰ ਬਣਾ ਕੇ ਲਗਾਈ ਸੀ ਉਸ ਤੋਂ ਇਲਾਵਾ ਮੈਨੂੰ ਜ਼ਿਆਦਾਤਰ ਕਾਰਟੂਨਜ਼ ਦੀ ਤਸਵੀਰਾਂ ਬਣਾਉਣਾ ਪਸੰਦ ਹੈ ਤਾਂ ਮੈਂ ਕਾਰਟੂਨ ਦੀ ਤਸਵੀਰਾਂ ਬਣਾ ਕੇ ਘਰ 'ਚ ਲਗਾ ਕੇ ਸਜਾਉਂਦੀ ਹਾਂ